ਹੈਲੋ ਮੈਂ ਗੁਰਦਾਸਪੁਰ ਤੋ ਰਾਜ ਕੁਮਾਰੀ ਬੋਲ ਰਹੀ ਹਾਂ ਪੰਜ ਨਾਂਵਾ ਦੇ ਪੰਜਾਂ ਦੇ ਨਾਂ ਦੱਸਾਂਗੀ ਭਾਵਨਾ ਮਾਨਿਕ ਅਤੁਲ ਕੰਨੁ ਮਾਲਤੀ